ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡੀ ਟਰਾਂਸਪੋਰਟ ਕੰਪਨੀ 'ਚੋਂ ਕੁਝ ਕਾਰਾਂ ਅਤੇ ਕੈਬ ਬੁੱਕ ਕਰਨੀਆਂ ਹਨ ਜਿਸਦੇ ਵਿੱਚ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੱਕ ਯਾਤਰਾ ਕਰਨ ਦਾ ਵਿਚਾਰ ਕੀਤਾ ਹੈ ਜਿਸਦੇ ਵਿੱਚ ਅਸੀਂ ਸਾਡੇ ਚਾਚਾ ਜੀ ਸਾਡੇ ਤਾਇਆ ਜੀ ਦੇ ਪਰਿਵਾਰ ਦੇ ਮੈਂਬਰ ਹੋਣਗੇ ਜਿਸ ਲਈ ਸਾਨੂੰ ਘੱਟੋ ਘੱਟ ਤਿੰਨ ਜਾਂ ਚਾਰ ਕਾਰਾਂ ਚਾਹੀਦੀਆਂ ਹਨ ਅਤੇ ਅਸੀਂ ਰਸ ਦੇ ਰਸਤੇ ਦੇ ਵਿੱਚ ਵੀ ਫਤਿਹਗੜ੍ਹ ਸਾਹਿਬ ਤੋਂ ਸਿੱਧਾ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਅਤੇ ਫੇਰ ਜਲੰਧਰ ਤੋਂ ਕੁਝ ਕੁ ਖਾ ਖਾ ਪੀ ਕੇ ਆਪਣਾ ਸ਼੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਵਿੱਚ ਸਿੱਧਾ ਜਾਵਾਂਗੇ ਅਤੇ ਰਸਤੇ ਦੇ ਵਿੱਚ ਆਉਂਦੇ ਹੋਏ ਜਲੰਧਰ ਹਵੇਲੀ ਵੀ ਘੁੰਮਾਂਗੇ ਅਤੇ ਲੁਧਿਆਣੇ ਤੋਂ ਕੁਝ ਸਮਾਨ ਵੀ ਖਰੀਦਾਂਗੇ ਅਤੇ ਇਸ ਦਾ ਤੁਹਾਨੂੰ ਕਿਰਾਇਆ ਹਰ ਇੱਕ ਦਿਨ ਦਾ ਅਤੇ ਘੰ ਦਿੱਤਾ ਜਾਵੇਗਾ ਧੰਨਵਾਦ ਜੀ